ਦੁਨੀਆਂ ਵਿੱਚ ਭਾਰਤੀ ਕਲਾ ਅਤੇ ਕਲਾਕਾਰਾਂ ਦੀ ਪ੍ਰਤੀਨਿਧਤਾ ਵਧਾਉਣ ਲਈ ਵੱਖ ਵੱਖ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਜਿਹਦੇ ਵਿੱਚ ਵੱਡੇ ਅਤੇ ਛੋਟੇ ਕਲਾਕਾਰਾਂ ਨੂੰ ਬੁਲਾ ਕੇ ਉਨ੍ਹਾਂ ਉਨ੍ਹਾਂ ਦੇ ਟੈਲੇਂਟ ਨੂੰ ਦੇਖਣਾ ਚਾਹੀਦਾ ਹੈ ਟੈਲੇਂਟ ਨੂੰ ਦੇਖਦੇ ਦੇਖਦੇ ਹੋਏ ਸਾਨੂੰ ਉਹਨਾਂ ਨੂੰ ਪ੍ਰਾਈਜ਼ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਕਿ ਜੋ ਉਹਨਾਂ ਦੀ ਮਨੋਬਲ ਹੈ ਉਹ ਵੱਧ ਸਕੇ ਅਤੇ ਉਹਨਾਂ ਨੂੰ ਖੁਸ਼ੀ ਮਿਲ ਸਕੇ